ਪੰਜਾਬ ਵਿੱਚ ਕਾਰੋਬਾਰ ਆਪਣੀ ਸੰਚਾਲਨ ਅਤੇ ਉਤਪਾਦਾਂ ਨੂੰ ਬਿਹਤਰ ਬਣਾਉਣ ਲਈ ਟੈਕਨੋਲੋਜੀ ਅਤੇ ਨਵੀਨਤਾ ਦੀ ਵਰਤੋਂ ਕਰ ਰਿਹਾ ਏ ਹੈ ਆਧੁਨਿਕ ਸਾਫਟਵੇਅਰ ਐਪਲੀਕੇਸ਼ਨ ਜਿਵੇਂ ਈ ਆਰ ਪੀ ਹੋ ਗਿਆ ਅਤੇ ਸੀ ਆਰ ਐਮ ਹੋ ਗਿਆ ਕਾਰੋਬਾਰੀ ਪ੍ਰਬੰਧਨ ਨੂੰ ਆਸਾਨ ਬਣਾਉਂਦੇ ਹਨ ਉਦਯੋਗ ਆਪਣੀ ਕਰਮਚਾਰੀ ਨੂੰ ਨਵੀਆਂ ਟੈਕਨੋਲੋਜੀ ਉੱਤੇ ਟ੍ਰੇਨਿੰਗ ਦੇ ਰਹੇ ਹਨ ਜਿਸ ਨਾਲ ਉਤਪਾਦਨ ਦੀ ਗੁਣਵੱਤਾ ਅਤੇ ਗਤੀ ਦੋਵਾਂ ਵਿੱਚ ਸੁਧਾ ਸੁਧਾਰ ਆਉਂਦਾ ਪਿਆ ਵਾ ਰੁਜ਼ਗਾਰ ਦੇ ਨਵੇਂ ਮੌਕਿਆਂ ਦੀ ਗੱਲ ਕਰੀਏ ਤਾਂ ਅਸੀਂ ਆਈ ਟੀ ਅਤੇ ਈਕੋਮਰਸ ਵਰਗੇ ਖੇਤਰਾਂ ਵਿੱਚ ਨੌਜਵਾਨਾਂ ਲਈ ਨਵੇਂ ਅਵਸਰ ਉਬਰ ਰਹੇ ਉਭਰ ਕੇ ਆ ਰਹੇ ਹਨ ਆਟੋਮੈਟਿਕ ਇੰਸਪੈਕਸ਼ਨ ਉਪਕਰਨ ਅਤੇ ਆਈ ਓ ਟੀ ਸਨਸੋਰ ਵਰਤ ਕੇ ਉਦਯੋਗ ਉਤਪਾਦਾਂ ਦੀ ਗੁਣਵੱਤਾ ਯਕੀਨੀ ਬਣਾ ਰਹੇ ਹਨ ਖੇਤੀ ਅਤੇ ਨਿਰਮਾਣ ਖੇਤਰ ਵਿੱਚ ਡਰੋਨ ਹੋ ਗਿਆ ਸੀ ਐਨ ਸੀ ਮਸ਼ੀਨਰੀ ਹੋ ਗਈ ਅਤੇ ਸਮਾਰਟ ਇਰੀਗੇਸ਼ਨ ਸਿਸਟਮ ਵਰਗੀਆਂ ਤਕਨੀਕਾਂ ਵਧੇਰੇ ਜੋੜ ਫੜਦੀਆਂ ਪਈਆਂ ਅੱਜ ਕੱਲ੍ਹ ਇਸ ਸਭ ਦੇ ਨਾਲ ਡਿਜੀਟਲ ਮਾਰਕੀਟਿੰਗ ਹੋ ਗਈ ਹੈ ਅਤੇ ਈਕਮਰਸ ਦੀ ਵਰਤੋਂ ਕਰਕੇ ਪੰਜਾਬ ਦੇ ਕਾਰੋਬਾਰ ਆਪਣੇ ਉਤਪਾਦ ਵਿਦੇਸ਼ੀ ਬਜ਼ਾਰ ਤੱਕ ਪਹੁੰਚਾ ਰਹੇ ਹਨ ਇਹ ਸਾਰੇ ਤਰੀਕੇ ਪੰਜਾਬ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਅਤੇ ਉਦਯੋਗਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਰਹੇ ਹਨ